ਸਤਿ ਸ਼੍ਰੀ ਅਕਾਲ ਜੀ ਪਿੰਡਾਂ ਵਿੱਚ ਉੱਦਾਂ ਤਾਂ ਬਹੁਤ ਸਾਰੀਆਂ ਖੇਡਾਂ ਨੇ ਪਰ ਮੈਂ ਕੁਝ ਕੁ ਖੇਡਾਂ ਦਾ ਵਰਣਨ ਤੁਹਾਡੇ ਨਾਲ ਕਰਨ ਜਾ ਰਹੀ ਹਾਂ ਜਿਵੇਂ ਕਿ ਸਟੈਪੂ ਬਾਂਦਰ ਕਿੱਲਾ ਖੋ ਖੋ ਪਿੱਠੂ ਗਰਮ ਕਬੱਡੀ ਹਾਕੀ ਇੱਦਾਂ ਦੀਆਂ ਬਹੁਤ ਹੋਰ ਵੀ ਸਾਰੀਆਂ ਖੇਡਾਂ ਨੇ ਜਿਵੇਂ ਕਿ ਅਸੀਂ ਛੋਟੇ ਹੁੰਦੇ ਸਟੈਪੂ ਖੇਡਦੇ ਹੁੰਦੇ ਹਾਂ ਸਟੈਪੂ ਨੂੰ ਅਸੀਂ ਇੱਕ ਚੋਕ ਦੇ ਨਾਲ ਡੱਬੇ ਉਹਦੇ ਬਣਾ ਲੈਂਦੇ ਹੁੰਦੇ ਸਾਂ ਉਹਦੇ ਵਿੱਚ ਆਪਾਂ ਨੰਬਰ ਲਿਖ ਲੈਂਦੇ ਹਾਂ ਇੱਕ ਦੋ ਤਿੰਨ ਚਾਰ ਅੱਠ ਕੁ ਡੱਬਿਆਂ ਦਾ ਅਸੀਂ ਸਟੈਪੂ ਬਣਾ ਲੈਣਾ ਫਿਰ ਅਸੀਂ ਬੱਚਿਆਂ ਬੱਚਿਆਂ ਨੇ ਇਕੱਠੇ ਹੋ ਕੇ ਉਹਨੂੰ ਖੇਡਣਾ ਇੱਕ ਲੱਕੜ ਦੀ ਠੀਕਰੀ ਬਣਾ ਲੈਂਦੇ ਸੀ ਜੋ ਕਿ ਉਹਦੇ ਵਿੱਚ ਪਾ ਕੇ ਅਤੇ ਉਸ ਨੂੰ ਠੁੱਡੇ ਮਾਰ ਮਾਰ ਕੇ ਖੇਡਦੇ ਹੁੰਦੇ ਹਾਂ ਫਿਰ ਖੇਡਦਿਆਂ ਖੇਡਦਿਆਂ ਇਸ ਤਰ੍ਹਾਂ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿਸੇ ਵੇਲੇ ਡਿੱਗ ਵੀ ਜਾਣਾ ਅਤੇ ਉਸ ਦਾ ਹੱਸੀ ਮਜ਼ਾਕ ਬਣਾਉਣਾ ਫਿਰ ਅਸੀਂ ਉਹਨੂੰ ਉਠਾਉਣਾ ਨਹੀਂ ਕਿਸੇ ਦੇ ਦਾ ਮਜ਼ਾਕ ਦਾ ਗੁੱਸਾ ਨਹੀਂ ਕਰਨਾ ਫਿਰ ਆਪਾਂ ਪਿੱਠੂ ਗਰਮ ਵੀ ਖੇਡਣਾ ਉਸ ਦੇ ਵਿੱਚ ਕੀ ਹੁੰਦਾ ਸੀ ਉਹਦੇ ਵਿੱਚ ਕੁਝ ਕੁ ਠੀਕਰੀਆਂ ਲੈ ਕੇ ਅਤੇ ਉਹਨਾਂ ਦਾ ਅਸੀਂ ਇੱਕ ਇਕੱਠੀਆਂ ਠੀਕਰੀਆਂ ਕਰ ਲੈਣੀਆਂ ਇੱਕ ਦੇ ਉੱਪਰ ਇੱਕ ਇੱਕ ਦੇ ਉੱਪਰ ਇੱਕ ਫਿਰ ਉਹ ਨੂੰ ਅਸੀਂ ਬੋਲ ਦੇ ਨਾਲ ਥੱਲੇ ਸੁੱਟਣਾ ਫਿਰ ਜਿਸ ਨੇ ਸੁੱਟ ਲੈਣਾ ਉਹ ਨੂੰ ਮਤਲਬ ਕਿ ਪੁਆਇੰਟ ਮਿਲਦੇ ਹੁੰਦੇ ਸੀ ਫਿਰ ਜਿਵੇਂ ਵੇਖਿਆ ਜਾਵੇ ਕਿ ਕਬੱਡੀ ਕਬੱਡੀ ਵੀ ਅੱਜ ਕੱਲ੍ਹ ਸਾਡੇ ਪੰਜਾਬ ਦਾ ਨੈਸ਼ਨਲ ਪੱਧਰ ਖੇਡ ਹੈ ਜੋ ਕਿ ਅੱਜ ਕੱਲ੍ਹ ਉਹ ਪਹਿਲਾਂ ਤਾਂ ਮੁੰਡੇ ਹੀ ਖੇਡਦੇ ਸੀ ਅੱਜ ਕੱਲ੍ਹ ਕੁੜੀਆਂ ਵੀ ਖੇਡਦੀਆਂ ਨੇ ਕੁੜੀਆਂ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ ਕੁੜੀਆਂ ਵੀ ਬਹੁਤ ਵਧੀਆ ਕਬੱਡੀ ਖੇਡਦੀਆਂ ਨੇ ਹਾਕੀ ਹਾਕੀ ਵੀ ਮੁੰਡਿਆਂ ਨਾਲੋਂ ਜ਼ਿਆਦਾ ਵਧੀਆ ਕੁੜੀਆਂ ਵੀ ਖੇਡਦੀਆਂ ਨੇ ਧੰਨਵਾਦ